ਪੰਜਾਬ ਦੇ ਵਿੱਚ ਕਲਾ ਅਤੇ ਸ਼ਿਲਪ ਖੇਤਰ ਦੇ ਵਿੱਚ ਜਿਵੇਂ ਕਿ ਫਿਲਮਾਂ ਦੇ ਫੈਸ਼ਨ ਡਿਜ਼ਾਇਨਿੰਗ ਅਤੇ ਇਸ਼ਤਿਹਾਰਬਾਜ਼ੀ ਕਹਿ ਲਓ ਜਿਹੜੇ ਮੇਨ ਹੈ ਅਤੇ ਇਹਦੇ ਵਿੱਚ ਜਿਵੇਂ ਫਿਲਮਾਂ ਦੇ ਵਿੱਚ ਆ ਜੋ ਉਦਯੋਗ ਆ ਜਿਹੜੇ ਚੱਲ ਰਹੇ ਆ ਜਿਵੇਂ ਫਿਲਮਾਂ ਦੇ ਵਿੱਚ ਜੋ ਮੈਨੇਜਮੈਂਟ ਨੂੰ ਸਾਂਭਣੇ ਕਰਨੇ ਦਾ ਜੋ ਵੀ ਕੈਮਰਾਜ਼ ਵਗੈਰਾ ਯੂਜ਼ ਹੁੰਦੇ ਆ ਅਤੇ ਉਹਨਾਂ ਨੂੰ ਲੋਕਾਂ ਨੂੰ ਰੁਜ਼ਗਾਰ ਮਿਲਦਾ ਆ ਉਸ ਮੈਨੇਜਮੈਂਟ ਨੂੰ ਸਾਂਭਣ ਦੇ ਲਈ ਅਤੇ ਜਿਹੜੇ ਮੇਨ ਰੋ ਰੋਲ ਪਲੇਅ ਕਰਦੇ ਆ ਫਿਲਮਾਂ ਦੇ ਵਿੱਚ ਜਿਵੇਂ ਕਿ ਮੋਟੀਵੇਸ਼ਨਲ ਫਿਲਮਜ਼ ਬਣਦੀਆਂ ਏ ਆ ਅਤੇ ਉਹਨਾਂ ਨੂੰ ਦੇਖ ਕੇ ਜੋ ਲੋਕ ਆ ਆਪਣੀ ਜ਼ਿੰਦਗੀ ਦੇ ਵਿੱਚ ਜੋ ਮੋਟੀਵੇਟ ਹੁੰਦੇ ਆ ਜਾਗਰੂਕ ਹੁੰਦੇ ਆ